ਪਾਣੀ ਨੂੰ ਫਿਲਟਰ ਕਰਨ ਲਈ ਅਤੇ ਸ਼ੁੱਧ ਕਰਨ ਲਈ ਬਹੁਤ ਸਾਰੇ ਘਰੇਲੂ ਇਲਾਜ ਹਨ ਜਿਵੇਂ ਕਿ ਆਪਾਂ ਪਹਿਲੇ ਪੁਰਾਣੇ ਜ਼ਮਾਨੇ ਵਿੱਚ ਪਹਿਲੇ ਤਾਂ ਆਪਾਂ ਪਾਣੀ ਨੂੰ ਬੋਇਲ ਕਰਕੇ ਗਰਮ ਕਰਕੇ ਉਹਨੂੰ ਸ਼ੁੱਧ ਕਰ ਸਕਦੇ ਸਾਂ ਪਰ ਹੁਣ ਤਾਂ ਨਵੇਂ ਨਵੇਂ ਇਹ ਇਲਾਜ ਆ ਸਕ ਆ ਗਏ ਹਨ ਘਰੇਲੂ ਇਲਾ ਘਰੇਲੂ ਇਲਾਜ ਹੋਰ ਵੀ ਹਨ ਜਿਵੇਂ ਕਿ ਆਪਾਂ ਪਹਿਲ ਹੁਣ ਮਿੱਟੀ ਦੇ ਭਾਂਡੇ ਵਿੱਚ ਆਪਾਂ ਕਰ ਸਕਦੇ ਹਾਂ ਤਾਂਬੇ ਦੇ ਭਾਂਡੇ ਵਿੱਚ ਆਪਾਂ ਪਾਣੀ ਨੂੰ ਸ਼ੁੱਧ ਕਰ ਸਕਦੇ ਹਨ ਅਤੇ ਹੁਣ ਤਾਂ ਆਪਾਂ ਨਵੇਂ ਨਵੇਂ ਇਲਾਜ ਆ ਚੁੱਕੇ ਹਨ ਜਿਵੇਂ ਕਿ ਫਿਲਟਰ ਆ ਗਿਆ ਹੈ ਜਿਵੇਂ ਕਿ ਆਪਾਂ ਉਹਨਾਂ ਨੂੰ ਚਲਾਉਂਦੇ ਹਾਂ ਅਤੇ ਉਹ ਫਿਲਟਰ ਹੋ ਕੇ ਪਾਣੀ ਆ ਜਾਂਦਾ ਹੈ ਅਲਟਰਾ ਅਲਟਰਾ ਵਾਇਲਟ ਰੇਜ ਦੇ ਨਾਲ ਵੀ ਆਪਾਂ ਪਾਣੀ ਨੂੰ ਕਰ ਸਕਦੇ ਹਾਂ ਸ਼ੁੱਧ ਕਰ ਸਕਦੇ ਹਾਂ ਫਿਰ ਆਪਾਂ ਉਹਦੇ ਵਿੱਚ ਟੈਬਲੇਟਸ ਪਾ ਕੇ ਵੀ ਆਪਾਂ ਉਹਨੂੰ ਪਾਣੀ ਨੂੰ ਸ਼ੁੱਧ ਕਰ ਸਕਦੇ ਹਾਂ ਅਤੇ ਹੋਰ ਵੀ ਤਾਂ ਜੋ ਸਾਡੀ ਸਿਹਤ ਠੀਕ ਰਹਿ ਕ ਰਹੇ ਫਿਲਟਰ ਪਾਣੀ ਪੀਣ ਦੇ ਨਾਲ ਅਤੇ ਆਪਾਂ ਬਿ ਕਦੀ ਬਿਮਾਰ ਨਾ ਹੋ ਸਕੀਏ ਅਤੇ ਇਸ ਲਈ ਘਰੇਲੂ ਇਲਾਜ ਹੋਰ ਵੀ ਹਨ ਜਿਵੇਂ ਕਿ ਆਪਾਂ ਮਟਕੇ ਮਟਕੇ ਵਿੱਚ ਪਾਣੀ ਪਾ ਕੇ ਦੋ ਤਿੰਨ ਇੱਕ ਦਿਨ ਲਈ ਰੱਖ ਕੇ ਆਪਾਂ ਇਹਨਾਂ ਨੂੰ ਪੀ ਸਕਦੇ ਹਾਂ ਫਿਰ ਆਪਾਂ ਉਹਨਾਂ ਨੂੰ ਤਾਂਬੇ ਦੇ ਭਾਂਡੇ ਵਿੱਚ ਪੀ ਸਕਦੇ ਹਾਂ ਤਾਂ ਜੋ ਸਾਨੂੰ ਕੋਈ ਬਿਮਾਰੀ ਨਾ ਹੋ ਸਕੇ ਇਸ ਲਈ ਤਾਂਬੇ ਦੇ ਪ ਪਾਣੀ ਵਿੱਚ ਪਾਣੀ ਤਾਂਬੇ ਦੇ ਬਾਟੇ ਵਿੱਚ ਪਾਣੀ ਪੀਣਾ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਸ਼ੁੱਧ ਸ਼ੁੱਧ ਮੰਨਿਆ ਜਾਂਦਾ ਹੈ ਅਤੇ ਇਸ ਲਈ ਆਪਾਂ ਨੂੰ ਹਮੇਸ਼ਾ ਪਹਿਲੇ ਪੁਰਾਣੇ ਜ਼ਮਾਨੇ ਵਿੱਚ ਤਾਂ ਲੋਕ ਤਾਂਬੇ ਦੇ ਭਾਂਡੇ ਭਾਂਡੇ ਵਿੱਚ ਘੜਿਆਂ ਵਿੱਚ ਪਾਣੀ ਪੀਂਦੇ ਸਨ ਪਰ ਹੁਣ ਤਾਂ ਇਹ ਜ਼ਮਾਨਾ ਆ ਚੁੱਕਾ ਹੈ ਕਿ ਲੋਕਾਂ ਨੂੰ ਕੋਈ ਕੰਮ ਨਹੀਂ ਕਰਨਾ ਪੈਂਦਾ ਬਸ ਉਹ ਫਿਲਟਰ ਲਗਵਾਉਂਦੇ ਹਨ ਅਤੇ ਉਹ ਫਿਲਟਰ ਦਾ ਪਾਣੀ ਪੀ ਲੈਂਦੇ ਹਨ ਇਸ ਲਈ ਸਾਨੂੰ ਆਪਣੇ ਪੁਰਾਣੇ ਰਿਵਾਜ਼ਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਤਾਂ ਜੋ ਇਹ ਕੰਮ ਆ ਸਕਣ ਕਦੀ ਨਾ ਕਦੀ ਇਹ ਕੰਮ ਆ ਸਕਣ ਪਰ ਜੋ ਗਰੀਬ ਬੰਦਾ ਹੁੰਦਾ ਹੈ ਉਹ ਫਿਲਟਰ ਨਹੀਂ ਲਗਵਾ ਸਕਦਾ ਇਸ ਲਈ ਉਹ ਘੜਿਆਂ ਘੜਿਆਂ ਨੂੰ ਲਿਆ ਕੇ ਜਾਂ ਤਾਂਬੇ ਦੇ ਭਾਂਡੇ ਲੈ ਕੇ ਉਹ 'ਚ ਪਾਣੀ ਪੀ ਸਕਦਾ ਤਾਂ ਜੋ ਉਹਦੀ ਵੀ ਤਬੀਅਤ ਠੀਕ ਰਹੇ ਅਤੇ ਸਾਡੀ ਵੀ